ਅਜੋਕੇ ਸਮੇਂ ਦੌਰਾਨ ਔਰਤਾਂ ਕਿਸੇ ਵੀ ਪੱਖੋਂ ਘੱਟ ਨਹੀਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਗਾ ਕੇ ਹਰੇਕ ਖੇਤਰ ਵਿੱਚ ਮੋਹਰੀ ਰੋਲ ਨਿਭਾਉਂਦੀਆਂ ਹਨ ਇਸ ਤਰ੍ਹਾਂ ਖੇਡਾਂ ਵਿੱਚ ਵੀ ਔਰਤਾਂ ਆਪਣਾ ਖਾਸ ਸਥਾਨ ਰੱਖਦੀਆਂ ਹਨ ਬਹੁਤ ਸਾਰੀਆਂ ਔਰਤਾਂ ਜਿਵੇਂ ਪੀ ਵੀ ਸਿੰਧੂ ਸਾਨੀਆ ਮਿਰਜ਼ਾ ਮੈਰੀ ਕੌਮ ਸਾਨੀਆ ਨੇਹਵਾਲ ਦੀਪਾ ਕਰਮਕਾਰ ਮਿਥਾਲੀ ਰਾਜ ਦੀਪਕਾ ਕੁਮਾਰੀ ਗੀਤਾ ਰੋਹਗਤ ਸਾਕਸ਼ੀ ਮਲਿਕ ਹਿਮਾਦਾਸ ਜਿਹੀਆਂ ਬਹੁਤ ਸਾਰੀਆਂ ਔਰਤਾਂ ਨੇ ਖੇਡਾਂ ਵੱਖ ਵੱਖ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਏ ਭਾਰਤ ਦੇਸ਼ ਵੱਲੋਂ ਵੀ ਸਰਕਾਰਾਂ ਵੱਲੋਂ ਵੀ ਸਮੇਂ ਸਮੇਂ ਦੀਆਂ ਵੱਲੋਂ ਏ ਇਹਨਾਂ ਨੂੰ ਔਰਤਾਂ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਹਰੇਕ ਖੇਡਾਂ ਵਿੱਚ ਮੌਕੇ ਦਿੱਤੇ ਜਾਂਦੇ ਹਨ ਤਾਂ ਜੋ ਔਰਤਾਂ ਆਪਣੀ ਪ੍ਰਤਿਭਾ ਨੂੰ ਹੋਰ ਵੀ ਨਿਖਾਰ ਸਕਣ